ਹੈਲੋ ਨਮਸ਼ ਨਮਸ਼ਕਾਰ ਹਾਂਜੀ ਤੁਸੀਂ ਕੌਣ ਉਨ੍ਹਾਂ ਦੇ ਕੀ ਬੋਲ ਰਹੇ ਹੋ ਠੀਕ ਹੈ ਨਮਸ਼ਕਾਰ ਸਰ ਕੀ ਪੁੱਛਣਾ ਚਾਹ ਰਹੇ ਹੋ ਮੈਂ ਕਾਫ਼ੀ ਸਕੂਲਾਂ ਦੀ ਰਿਸਰਚ ਕੀਤੀ ਕਾਫ਼ੀ ਸਕੂਲਾਂ ਬਾਰੇ ਪਤਾ ਕੀਤਾ ਹੈ ਹਾਂ ਹਾਂਜੀ ਜਿਵੇਂ ਆਤਮ ਬੱਲਮ ਆਰਮੀ ਸਕੂਲ ਅਤੇ ਵਿਸਡਮ ਸਕੂਲ ਇੱਕ ਕੋਨਵੈਂਟ ਸਕੂਲ ਹੈਗਾ ਹੈ ਸੈਕਰਟ ਹਾਰਟ ਕਾਫ਼ੀ ਪਤਾ ਕੀਤਾ ਕਿਸੇ 'ਚ ਅੱਛੇ ਸਕੂਲ ਤਾਂ ਸਾਰੇ ਹੀ ਨੇ ਬਾਕੀ ਆਪਾਂ ਆਪਣੇ ਬੱਚੇ ਦੀ ਰਿਕੁਆਇਰਮੈਂਟ ਦੇ ਹਿਸਾਬ 'ਤੇ ਹੀ ਉਨ੍ਹਾਂ ਨੂੰ ਕਰ ਸਕਦੇ ਐਡਮਿਟ ਹੈਂ ਜੀ ਫਰਕ ਤਾਂ ਸਿਰਫ਼ ਸਿਲੇਬਸ ਦਾ ਹੀ ਆਏਗਾ ਜੀ ਕਿਉਂਕਿ ਕੋਨਵੈਂਟ ਦਾ ਸਿਲੇਬਸ ਬਹੁਤ ਜ਼ਿਆਦਾ ਹੈ ਬੱਚੇ ਦੇ ਮੈਂਟਲ ਲੈਵਲ ਤੋਂ ਫਿਰ ਕੁਛ ਸਪੋਟਸ ਐਕਟੀਵਿਟੀ ਬਹੁਤ ਘੱਟ ਨੇ ਉਸ ਸਕੂਲ ਵਿੱਚ ਤਾਂ ਬਰਡਨ ਕਰਕੇ ਫੇਰ ਬੱਚਾ ਕਈ ਵਾਰੀ ਇੰਨਾਂ ਨਹੀਂ ਸਿਲੇਬਸ ਕਵਰ ਕਰ ਪਾਏਗਾ ਟਾਈਮ ਏਜ ਵਾਇਜ ਕਈ ਵਾਰੀ ਬੱਚੇ ਦਾ ਇੰਟ੍ਰਸਟ ਉਨ੍ਹਾਂ ਚੀਜ਼ਾਂ 'ਚ ਨਹੀਂ ਹੁੰਦਾ ਮੇਰਾ ਬੇਟਾ ਥੋੜ੍ਹਾ ਸਪੋਟਸ ਵਿੱਚ ਐਕਟਿਵ ਹੈ ਮੈਨੂੰ ਕੁਛ ਉਨ੍ਹਾਂ ਚੀਜ਼ਾਂ ਦਾ ਵੀ ਧਿਆਨ ਰੱਖ ਕੇ ਉਹਨੂੰ ਲੈ ਕੇ ਜਾਣਾ ਪਏਗਾ ਅੱਗੇ ਅੱਛਾ ਹਾਂਜੀ ਕੁਛ ਐਕਸਟਰਾ ਐਕਟੀਵਿਟੀ ਹੋਣੀਆਂ ਵੀ ਜ਼ਰੂਰੀ ਨੇ ਫਿਰ ਸਟੱਡੀ ਨੂੰ ਹੀ ਲੈ ਕੇ ਨਹੀਂ ਕਰ ਸਕਦੇ ਆਪਾਂ ਅਤੇ ਮੈਂ ਹਾਂ ਕੋਸ਼ਿਸ਼ ਹੈ ਕਿ ਸਾਰੀਆਂ ਚੀਜ਼ਾਂ ਅਗਰ ਮਿਲ ਜਾਣ ਤਾਂ ਬਹੁਤ ਅੱਛੀ ਗੱਲ ਏ ਕਿਉਂਕਿ ਸਿਰਫ਼ ਸਟੱਡੀ ਨੂੰ ਵੀ ਤਾਂ ਨਹੀਂ ਕ ਦੇਖ ਸਕਦੇ ਇਕੱਲਾ ਸਟੱਡੀ ਹਾਂ ਪੀ ਤੁਹਾਡੇ ਬੱਚੇ ਦਾ ਇੰਟ੍ਰਸਟ ਤੁਸੀਂ ਦੇਖੋ ਕਿਸ ਤਰ੍ਹਾਂ ਹੈ ਜ਼ਿਆਦਾ ਹੂੰ ਠੀਕ ਹੈ ਸਕੂਲ ਆਰਮੀ ਸਕੂਲ ਠੀਕ ਹੈ ਅੱਛਾ ਹੈ ਸਟਾਫ਼ ਵੀ ਅੱਛਾ ਹੈ ਉਹ ਵੀ ਦੇਖਣਾ ਪਏਗਾ ਕੁਆਲੀਫਾਈਡ ਹੈ ਹਾਂਜੀ ਫੇਰ ਕੁਛ ਉਨ੍ਹਾਂ ਦੇ ਐਡੀਕੇਟ ਮੈਨਰ ਸਭ ਕੁਛ ਕੇਲਕੂਲੇਟ ਕਰੀਏ ਤਾਂ ਆਰਮੀ ਸਕੂਲ 'ਚ ਮੈਂ ਟਰਾਈ ਕਰ ਰਹੀ ਹਾਂ ਅਗਰ ਹੋ ਜਾਏਗਾ ਤਾਂ ਵੈੱਲ ਐਨ ਗੁੱਡ ਹੈ ਜੀ

ਤਾਂ ਕਿ ਬੱਚੇ ਨੂੰ ਵੀ ਅੱਗੇ ਜਾ ਕੇ ਪ੍ਰੋਬਲਮ ਨਾ ਆਵੇ ਕਿਉਂਕਿ ਉਸ ਵਿੱਚ ਕੁਛ ਬਜਟ ਦੀ ਵੀ ਦੇਖ ਕੇ ਕਰਨੀ ਪਏਗੀ ਫੀਸਸ ਵਗੈਰਾ ਜਾਂ ਟ੍ਰਾਂਸਪੋਟ ਦਾ ਛੱਡਣਾ ਵੈਨ ਵਗੈਰਾ ਦੀ ਫਸਿਲਟੀ ਕੁਛ ਲੰਚ ਦੀ ਪ੍ਰੋਬਲਮ ਸਭ ਸਾਰੀਆਂ ਚੀਜ਼ਾਂ ਨੂੰ ਦੇਖਣਾ ਪਏਗਾ ਹਾਂਜੀ ਕਿਉਂਕਿ ਇੱਥੇ ਏਰੀਆ ਵਾਈਸ ਆਰਮੀ ਆਰਮੀ ਥੋੜ੍ਹਾ ਆਊਟ ਓਫ ਟਾਊਨ ਹੀ ਹੈ ਪਰ ਇੰਨਾਂ ਵੀ ਨਹੀਂ ਹੈਗਾ ਸਰਵਿਸ ਕਾਜ ਅਤੇ ਹਾਂਜੀ ਆਤਮ ਬੱਲਮ ਓਨ ਰੋਡ ਏ ਉਹ ਥੋੜ੍ਹਾ ਮੈਨੂੰ ਔਖਾ ਲੱਗ ਰਿਹਾ ਤਾਂ ਕਿ ਬੱਚੇ ਦਾ ਨਿਕਲਣਾ ਬਾਹਰ ਜਾਣਾ ਸੇਫ਼ਟੀ ਵੀ ਚਾਹੀਦੀ ਏ ਇਸ ਕਰਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਸਕੂਲ ਸਭ ਸਕੂਲ 'ਚ ਟ੍ਰਾਂਸਪੋਟ ਦਾ ਤਾਂ ਹੈਗਾ ਹੀ ਵੈਨ ਹੈ ਸਕੂਲ ਦੀ ਪਰ ਅਗਰ ਚੀਜ਼ ਹਾਂ ਉਹ ਆਪਾਂ ਆਪਣੇ ਹਿਸਾਬ ਨਾਲ ਕਰ ਸਕਦੇ ਹਾਂ ਅਰੇਂਜ ਅਗਰ ਖੁਦ ਜਾਈਏ ਤਾਂ ਵੈਰੀ ਗੁੱਡ ਹੈ ਨਹੀਂ ਤਾਂ ਬੱਚਿਆਂ ਨੂੰ ਫੇਰ ਵੈਨ ਦੇ ਅਕੋਡਿੰਗ ਤਿਆਰ ਕਰਨਾ ਪਏਗਾ ਸਪੀਡਲੀ ਰਿਫਰੈਸ਼ਮੈਂਟ ਹੈ ਕਾਫ਼ੀ ਮਤਲਬ ਆਪਣਾ ਖੁਦ ਦਾ ਵੀ ਲੰਚ ਆਪਾਂ ਭੇਜ ਸਕਦੇ ਹਾਂ ਬਾਕੀ ਉਹ ਹਾਂਜੀ ਬਾਕੀ ਉੱਥੇ ਜਾ ਕੇ ਹੀ ਆਪਾਂ ਦੇਖਾਂਗੇ ਤਾਂ ਫੇਰ ਪਤਾ ਚੱਲੇਗਾ ਹਾਂ ਬਾਕੀ ਦੇਖਦੇ ਹਾਂ ਬੱਚੇ ਦਾ ਕਿੱਥੇ ਬੱਚੇ ਦਾ ਵੀ ਇੰਟ੍ਰਸਟ ਬਣਦਾ ਹੈ ਅਤੇ ਬਾਕੀ ਮਿਲ ਕੇ ਆਪਾਂ ਉੱਥੇ ਜਾ ਕੇ ਪਤਾ ਕਰਦੇ ਹਾਂ ਚਲੋ ਮੈਂ ਤੁਹਾਨੂੰ ਸਕੂਲ 'ਚ ਮਿਲਦੀ ਹਾਂ ਜਲਦੀ ਉੱਥੇ